ਮੇਰੇ ਹਿਸਾਬ ਨਾਲ ਤਾਂ ਵਧੀਆ ਭੋਜਨ ਖੁੱਲ੍ਹੇ ਭਾਂਡੇ 'ਚ ਵਿੱਚ ਹੀ ਬਣਦਾ ਹੈ ਕਿਉਂਕਿ ਕੁੱਕਰ ਵਿੱਚ ਭੋਜਨ ਬਣਾਉਣ ਨਾਲ ਉਸਦੇ ਪੌਸ਼ਟਿਕ ਤੱਤ ਮਰ ਜਾਂਦੇ ਹਨ ਜਿਵੇਂ ਕਿ ਸ਼ਹਿਰਾਂ ਵਿੱਚ ਹਰ ਕੋਈ ਕੁੱਕਰ ਦੀ ਵਰਤੋਂ ਕਰਦਾ ਹੈ ਉਹਦਾ ਖਾਣੇ ਦਾ ਸਵਾਦ ਵੀ ਬਦਲ ਜਾਂਦਾ ਹੈ ਕੁੱਕਰ 'ਚ ਬਣਾਉਣ ਦਾ ਅਤੇ ਨਾਲ ਹੀ ਪੌਸ਼ਟਿਕ ਤੱਤ ਵੀ ਨਾਲ ਮਰ ਜਾਂਦੇ ਹਨ ਪਿੰਡਾਂ ਵਿੱਚ ਆਮ ਤੌਰ 'ਤੇ ਹਰ ਕੋਈ ਖੁੱਲ੍ਹੇ ਭਾਂਡੇ 'ਚ ਬਣਾਉਂਦਾ ਹੈ ਜਿਸ ਨਾਲ ਉਹਨਾਂ ਨੂੰ ਪੌਸ਼ਟਿਕ ਤੱਤ ਵੀ ਮਿਲਦੇ ਹਨ ਸਿਹਤਮੰਦ ਵੀ ਰਹਿੰਦੇ ਹਨ ਅਤੇ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ ਇਸ ਕਰਕੇ ਸਾਨੂੰ ਖੁੱਲੇ ਭਾਂਡੇ 'ਚ ਬਣਾਉਣਾ ਚਾਹੀਦਾ ਹੈ ਅਤੇ ਸਵਾਦ ਵੀ ਰਹਿੰਦਾ ਹੈ ਖਾਣਾ ਕੁੱਕਰ ਨਾਲ ਹੋਰ ਵੀ ਕਾਫੀ ਨੁਕਸਾਨ 'ਚ ਪੈ ਜਾਂਦੇ ਹਨ ਭੋਜਨ ਨਾਲ ਨਾ ਭੋਜਨ ਦਾ ਉਹ ਸਵਾਦ ਵੀ ਨਹੀਂ ਰਹਿੰਦਾ ਪਹਿਲਾਂ ਵਰਗਾ